ਸਾਡੇ ਖੇਤਰ ਵਿੱਚ ਪ੍ਰਮੁੱਖ ਜੰਗਲੀ ਜੀਵਾਂ ਨੂੰ ਰੱਖਣ ਵਾਸਤੇ ਘਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਸ ਲਈ ਚਿੜੀਆ ਘਰ ਜ਼ੂ ਆਦਿ ਛੱਤਬੀੜ ਆਦਿ ਬਣਾਏ ਜਾਂਦੇ ਹਨ ਜਿਹਦੇ ਵਿੱਚ ਕਿ ਇਹਨਾਂ ਜੰਗਲੀ ਜੀਵਾਂ ਨੂੰ ਰੱਖਿਆ ਜਾਂਦਾ ਹੈ ਇਹਨਾਂ ਜੰਗਲੀ ਜੀਵਾਂ ਨੂੰ ਉਹਦੇ ਵਿੱਚ ਰੱਖਣ ਦੇ ਦੋ ਫਾਇਦੇ ਹੁੰਦੇ ਹਨ ਇੱਕ ਤਾਂ ਅਸੀਂ ਇਹਨਾਂ ਦੀ ਪੂਰੀ ਤਰ੍ਹਾਂ ਦੀ ਸੰਭਾਲ ਹੋ ਜਾਂਦੀ ਹੈ ਦੂਸਰਾ ਇਹਨਾਂ ਦੀ ਪ੍ਰਜਾਤੀ ਜਿਹੜੀ ਹੈ ਲੁਪਤ ਨਹੀਂ ਹੁੰਦੀ ਅਤੇ ਅਸੀਂ ਇਹਦੇ ਕੋਂਟਰੀਬਿਊਸ਼ਨ ਵਾਸਤੇ ਪੈਸਿਆਂ ਦੀ ਮਦਦ ਕਰ ਸਕਦੇ ਹਾਂ ਤਾਂ ਕਿ ਜੋ ਉਹ ਚਿੜੀਆ ਘਰ ਵਾਲੇ ਹਨ ਉਹਨਾਂ ਪੈਸਿਆਂ ਨੂੰ ਇਹਨਾਂ ਦੇ ਸਾਂਭ ਸੰਭਾਲ ਦੇ ਵਿੱਚ ਵਰਤਿਆ ਜਾ ਸਕਣ ਘਰਾਂ ਦੇ ਵਿੱਚ ਇਹਨਾਂ ਨੂੰ ਸੰਭਾਲਣਾ ਜਾਂ ਰੱਖਣਾ ਬਹੁਤ ਔਖਾ ਹੋ ਜਾਂਦਾ ਹੈ ਨਹੀਂ ਰੱਖੇ ਜਾ ਸਕਦੇ ਖੂੰਖਾਰ ਅਤੇ ਜੰਗਲੀ ਜਾਨਵਰ ਹੁੰਦੇ ਹਨ ਜੋ ਕਿ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ ਇਹਨਾਂ ਨੂੰ ਘਰ ਦੇ ਬਾਹਰ ਖੁੱਲ੍ਹੇ ਹਵਾਦਾਰ ਮੈਦਾਨਾਂ ਜੋ ਕਿ ਜੰਗਲਾਂ ਵਾਂਗੂੰ ਬਣਾਇਆ ਜਾਂਦਾ ਹੈ ਉੱਥੇ ਹੀ ਰੱਖਿਆ ਜਾ ਸਕਦਾ ਹੈ ਅਤੇ ਉੱਥੇ ਹੀ ਰਹਿੰਦੇ ਨੇ